ਹੈਲੋ ਹਾਂਜੀ ਹਵੇਲੀ ਤੋਂ ਬੋਲ ਰਹੇ ਜੀ ਮੈਂ ਆਰਡਰ ਕੀਤਾ ਸੀ ਜੀ ਦਾਲ ਮੱਖਣੀ ਐਂਡ ਚਪਾਤੀ ਲੇਕਿਨ ਆਪ ਜੀ ਦਾ ਡਿਲੀਵਰੀ ਬੋਆਏ ਚਨਾ ਅਤੇ ਚਪਾਤੀ ਲੈ ਕੇ ਆ ਗਿਆ ਹੈ ਅਤੇ ਇਸ ਲਈ ਮੇਰਾ ਮੇਰੀ ਸ਼ਿਕਾਇਤ ਹੈ ਜੀ ਤੁਸੀਂ ਗਲਤੀ ਨਾਲ ਭੇਜਿਆ ਜਾਂ ਤੁਹਾਡਾ ਡਿਲੀਵਰੀ ਬੋਆਏ ਗਲਤ ਲੈ ਕੇ ਆਇਆ ਹੈ ਜਾਂ ਮੇਰਾ ਪੈਸਾ ਰਿਫੰਡ ਕਰੋ ਨਹੀਂ ਤਾਂ ਮੈਂ ਤੁਹਾਡੀ ਕੰਪਲੇਂਟ ਕਰਨ ਲੱਗਿਆ ਹਾਂ